ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਜਿਵੇਂ ਕਿ ਸਾਡੀ ਪੰਜਾਬ ਦੀ ਰਵਾਇਤ ਹੈ ਕਿ ਸਾਡੇ ਪੰਜਾਬ ਇੱਕ ਰਵਾਇਤੀ ਜੁੱਤੀਆਂ ਦੀ ਦੁਕਾਨ ਜਿਵੇਂ ਕਿ ਸਾਡੇ ਅੰਮ੍ਰਿਤਸਰ ਗੁਰਦਾਸਪੁਰ ਫਿਰ ਧਾਰੀਵਾਲ ਇਸ ਤਰ੍ਹਾਂ ਦੀਆਂ ਮਤਲਬ ਕਈ ਥਾਵਾਂ ਜਿੱਥੇ ਸਾਡੀ ਪੰਜਾਬੀ ਜੁੱਤੀਆਂ ਬਣਦੀਆਂ ਹਨ ਜੋ ਕਿ ਜਿਸਨੂੰ ਲੱਕੀ ਜੁੱਤੀ ਵੀ ਕਿਹਾ ਜਾਂਦਾ ਹੈ ਜਿਸ ਜਿਸ 'ਤੇ ਇੱਕ ਤਿੱਲ ਤਿੱਲੇ ਵਾਲੀ ਜੁੱਤੀ ਵੀ ਕਿਹਾ ਜਾਂਦਾ ਹੈ ਜਿਸਦੇ ਅੱਗੇ ਤਿੱਲਾ ਤਿੱਲਾ ਵੀ ਲੱਗਾ ਹੁੰਦਾ ਹੈ ਅਤੇ ਵੱਖ ਵੱਖ ਤਰ੍ਹਾਂ ਦੀ ਤਿੱਲੇ ਦੀ ਕਢਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਜੁੱਤੀਆਂ ਨੂੰ ਮੋਚੀਆਂ ਦੁਆਰਾ ਬਣਾਇਆ ਜਾਂਦਾ ਹੈ ਇਹਨਾਂ ਦੀਆਂ ਦੁਕਾਨਾਂ ਵੀ ਅਲੱਗ ਹੁੰਦੀਆਂ ਹਨ ਜਿੱਥੋਂ ਸਿਰਫ਼ ਪੰਜਾਬੀ ਜੁੱਤੀਆਂ ਅਤੇ ਲੱਕੀ ਜੁੱਤੀਆਂ ਹੀ ਮਿਲਦੀਆਂ ਹਨ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਜਾਈਏ ਤਾਂ ਉੱਥੇ ਵੀ ਇੱਕ ਲੱਕੀ ਜੁੱਤੀ ਦਾ ਬਜ਼ਾਰ ਵੱਖਰਾ ਹੀ ਹੁੰਦਾ ਹੈ ਜਿਸ ਵਿੱਚ ਸਿਰਫ ਪੰਜਾਬੀ ਜੁੱਤੀਆਂ ਹੀ ਮਿਲਦੀਆਂ ਹਨ ਜੋ ਕਿ ਸਾਡੇ ਪੁਰਾਣੇ ਲੋਕ ਪੁਰਾਣੇ ਲੋਕ ਸੀ ਉਹ ਇਹੀ ਪੰਜਾਬੀ ਜੁੱਤੀਆਂ ਪਾਉਂਦੇ ਸੀ ਅਤੇ ਹੁਣ ਦਾ ਕੁਝ ਸਮਾਂ ਹੋਰ ਹੈ ਪਰ ਹੁਣ ਨਹੀਂ ਪਰ ਫਿਰ ਵੀ ਇਹ ਇਹ ਜੁੱਤੀਆਂ ਕਾਫ਼ੀ ਵਰਤੀਆਂ ਜਾਂਦੀਆਂ ਹੈ ਇਹਨਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੀ ਮੋਤੀਆਂ ਦੀ ਕਢਾਈ ਸੁੱਚੇ ਮੋਤੀਆਂ ਦੀ ਕਢਾਈ ਕਾਫ਼ੀ ਤਰ੍ਹਾਂ ਦੀਆਂ ਕਢਾਈਆਂ ਕੀਤੀਆਂ ਜਾਂਦੀਆਂ ਹਨ ਸਾਡੇ ਗੁਰਦਾਸਪੁਰ ਪਠਾਨਕੋਟ ਇਸ ਤਰ੍ਹਾਂ ਦੀਆਂ ਜ ਸਾਡੇ ਗੁਰਦਾਸਪੁਰ ਪਠਾਨਕੋਟ ਸਾਡਾ ਇਸ ਤਰ੍ਹਾਂ ਦੀਆਂ ਕੁਝ ਥਾਵਾਂ ਹਨ ਜਿੱਥੇ ਲੱਕੀ ਜੁੱਤੀਆਂ ਦੀਆਂ ਮਸ਼ਹੂਰ ਦੁਕਾਨਾਂ ਹਨ ਜਿੱਥੇ ਸਿਰਫ਼ ਮੋਚੀਆਂ ਦੁਆਰਾ ਹੀ ਲੱਕੀ ਜੁੱਤੀਆਂ ਬਣਾਈਆਂ ਜਾਂਦੀਆਂ ਹਨ